ਹੈਲੋ ਸਤਿ ਸ਼੍ਰੀ ਅਕਾਲ ਜੀ

ਹਾਂਜੀ ਹਾਂਜੀ ਜੀ ਮੈਂ ਅਮਨ ਦਰੀਜ ਬੋਲ ਰਿਹਾ ਵਾ ਤੇ ਮੈਂ ਕਪੂਰਥਲੇ ਦਾ ਹੀ ਰਹਿਣ ਵਾਲਾ ਵਾਂ ਮੇਰਾ ਜਨਮ ਏਥੀ ਹੋਇਆ ਸੀ ਤੇ ਮੈਂ ਤੁਹਾਨੂੰ ਕਪੂਰਥਲੇ ਦੇ ਬਹੁਤ ਸਾਰੀਆਂ ਇਤਿਹਾਸ ਬਾਰੇ ਦੱਸ ਸਕਦਾ ਆ ਤੇ ਜਿਵੇਂ ਕਿ ਪੰਜ ਮੰਦਿਰ ਜੋ ਕਪੂਰਥਲਾ ਦੇ ਬਹੁਤ ਹੀ ਪ੍ਰਸਿੱਧ ਮੰਦਿਰ ਆ ਹਿਸਟਰੀ ਉਹ ਸਾਰੀ ਮਹਾਰਾਜਾ ਫਤਿਹ ਸਿੰਘ ਨੇ ਉੱਨੀਵੀਂ ਸਦਵੀਂ ਵਿੱਚ ਕਰਵਾਈ ਸੀਗੀ ਜੇਕਰ ਅਸੀਂ ਗੱਲ ਕਰੇ ਇਹ ਮੰਦਰ ਚ ਹਿੰਦੂ ਅਤੇ ਮੁਗਲ ਸਟਾਫ ਸਥਾਪਨਾ ਦਾ ਸ਼ਾਨਦਾਰ ਮਿਲਾਪ ਹੈ ਹਾਂਜੀ ਹਾਂਜੀ ਜਿਵੇਂ ਕਿ ਅਸੀਂ ਪੰਜਾਬ ਦੇ ਗੱਲ ਕਰੀਏ ਤੇ ਪੰਜਾਬ ਦੇ ਨਾਂ ਵੀ ਪੰਜ ਦਰਿਆਵਾਂ ਪੰਜ ਆਬਾ ਦੇ ਨਾਮ ਤੇ ਰੱਖਿਆ ਗਿਆ ਸੀ ਕਿਉਂਕਿ ਇਹਦੇ ਵਿੱਚ ਪੰਜ ਆਪ ਵਹਿੰਦੇ ਸੀ ਉਵੇਂ ਹੀ ਜਿਹੜਾ ਪੰਜ ਮੰਦੀ ਦਾ ਇਹਦੇ ਵਿੱਚ ਪੰਜ ਛੋਟੇ ਛੋਟੇ ਮੰਦਰਾਂ ਦਾ ਸਮੂਹ ਹੈ ਇਸ ਕਰਕੇ ਇਸਨੂੰ ਪੰਚ ਮੰਦਰ ਕਿਹਾ ਜਾਂਦਾ ਹੈ ਇੱਥੇ ਸ਼ਿਵ ਜੀ ਬਿੱਟੂ ਜੀ ਦੁਰਗਾ ਮਾਤਾ ਗਣੇਸ਼ ਜੀ ਅਤੇ ਹਨੁਮਾਨ ਜੀ ਦੇ ਮੰਦਰ ਹਨ ਕਹਿੰਦਾ ਪੰਜਾ ਮੰਦਰਾਂ ਕਰਕੇ ਇਸਨੂੰ ਪੰਜ ਮੰਦਰ ਕਿਹਾ ਜਾਂਦਾ ਹੈ ਹਾਂਜੀ ਹਾਂਜੀ ਜੇਕਰ ਅਸੀਂ ਗੱਲ ਤੁਹਾਨੂੰ ਜਿੱਦਾਂ ਮੈਂ ਦੱਸਿਆ ਕਿ ਇੱਥੇ ਸ਼ਿਵਜੀ ਦਾ ਮੰਦਰ ਹੈ ਟੈਂਕ ਸ਼ਿਵਰਾਤਰੀ ਵੀ ਮਨਾਈ ਜਾਂਦੀ ਹ ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਤੇ ਜਨਮ ਅਸ਼ਟਮੀ ਤੇ ਕ੍ਰਿਸ਼ਨ ਜੀ ਦਾ ਇੱਕ ਸਭ ਤੋਂ ਮਹੱਤਵਪੂਰਨ ਮੰਦੀ ਦਾ ਕਪੂਰਥਲੇ ਵਿੱਚ ਤਾਂ ਇੱਥੇ ਜਨਮਸ਼ਟਮੀ ਵੀ ਮਨਾਈ ਜਾਂਦੀ ਹੈ ਸ਼ਿਵਰਾਤਰੀ ਦੇ ਮੌਕੇ ਤੇ ਵਿਸ਼ੇਸ਼ ਸਮਾਗਮ ਹੁੰਦੇ ਹਨ ਤੇ ਇਸ ਕਰਕੇ ਇਥੇ ਬਹੁਤ ਸਾਰੇ ਡਰ ਸਮਾਗਮ ਮਨਾਏ ਜਾਂਦੇ ਹਾਂਜੀ ਹਾਂਜੀ ਜਿੱਦਾਂ ਜਿੱਦਾਂ ਕਿ ਧਾਰਮਿਕ ਸਥਾਨ ਇਥੇ ਅਸੀਂ ਧਾਰਮਿਕ ਭਜਨ ਕੀਰਤਨ ਪ੍ਰਸਾਦ ਵੰਡਣਾ ਧਿਆਨ ਜਿਵੇਂ ਕਿ ਅਸੀਂ ਉਹਨੂੰ ਧਿਆਨ ਜਿਵੇਂ ਕਿ ਅਸੀਂ ਉਹਨੂੰ ਇੰਗਲਿਸ਼ ਵਿੱਚ ਮੈਡੀਟੇਸ਼ਨ ਕਹਿ ਦਿੰਦੇ ਆ ਜਿਹੜਾ ਕਿ ਸਾਨੂੰ ਬਹੁਤ ਜਿਆਦਾ ਚਾਂਦ ਅਤੇ ਪਵਿੱਤਰ ਕਰ ਦਿੰਦਾ ਕਿਉਂਕਿ ਬਹੁਤ ਹੀ ਪਵਿੱਤਰ ਥਾਂ ਹੈ ਲੋਕ ਲੋਕ ਇਥੇ ਆਰਤੀ ਦੌਰਾਨ ਸ਼ਾਮਿਲ ਹੁੰਦੇ ਹਨ ਅਤੇ ਆਦਿ ਗ੍ਰੰਥ ਦੀ ਪਾਠ ਵੀ ਹੁੰਦੇ ਆ ਜੋ ਸੁਣ ਕੇ ਤੇ ਬਹੁਤ ਜਿਆਦਾ ਮਜਾ ਤੇ ਟਰਾਂਸਟੀ ਮਿਲਦੀ ਜੀ ਹਾਂਜੀ ਤੇ ਇਹਦਾ ਜਿਹੜਾ ਸਥਾਨ ਹ ਜਿਹੜਾ ਬੱਸ ਸਟੈਂਡ ਆ ਕਪੂਰਥਲੇ ਦਾ ਉਹਦੇ ਲਾਗੇ ਹੀ ਆ ਜਿੱਥੇ ਤੁਸੀਂ ਜਿੱਥੇ ਤੁਸੀਂ ਕਬੂਤਰੇ ਤੋਂ ਬਾਅਦ ਕਹਿਣ ਤੋਂ ਬਾਹਰ ਨਿਕਲੋਗੇ ਸੱਜੇ ਮੁੜ ਕੇ ਅਸੀਂ ਦੋ ਰਾਹ ਛੱਡੋਗੇ ਖੱਬਿਆਂ ਦੀ ਇਹ ਮੁੰਡੇ ਤੁਹਾਨੂੰ ਮਿਲ ਇਥੇ ਪੰਜ ਮੰਜੇ ਦਾ ਸਾਨੂੰ ਕਿੱਤੇ ਕਲਰ ਦਾ ਬਣਿਆ ਹੋਇਆ ਤੁਹਾਨੂੰ ਓਪੀ ਪਹਿਚਾਣ ਪਹਿਲੇ ਦੇਖਣ ਤੇ ਮਿਲ ਜਾਊਗੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਕਪੂਰਥਲਾ ਜੈਸੇ ਬਹੁਤ ਹੀ ਵਧੀਆ ਲੱਗੇਗਾ